ਸਿੱਖ ਧਰਮ ਵਿੱਚ ਧਾਰਮਿਕ ਪਰੰਪਰਾਵਾਂ ਰੀਤੀ ਰਿਵਾਜ਼ਾਂ ਦਾ ਪਾਲਣ ਕੀਤਾ ਜਾਂਦਾ ਹੈ ਅੱਜ ਲੋਕ ਸਿੱਖ ਧਰਮ ਵਿੱਚ ਲੋਕ ਸਿੱਖ ਧਰਮ ਦੀ ਬਹੁਤ ਹੀ ਮਹਾਨਤਾ ਕਰਦੇ ਹਨ ਅਤੇ ਬੋਹ ਉਹ ਅਤੇ ਉਹ ਹਰ ਇੱਕ ਦਾ ਹਰ ਇੱਕ ਲਈ ਵਧੀਆ ਅਰਦਾਸ ਮੰਗਦੇ ਹਨ ਅਤੇ ਕਿਸੇ ਲਈ ਵੀ ਗਲਤ ਅਰਦਾਸ ਨਹੀਂ ਮੰਗਦੇ ਉਹ ਕਿਸੇ ਨੂੰ ਵੀ ਕਿਸੇ ਨੂੰ ਵੀ ਬੁਰਾ ਭਲਾ ਨਹੀਂ ਕਹਿੰਦੇ ਸਿੱਖ ਧਰਮ ਵਿੱਚ ਸਿੱਖ ਧਰਮ ਵਿੱਚ ਅਰਦਾਸ ਦੀ ਬਹੁਤ ਮਹਾਨਤਾ ਹੈ ਲੋਕ ਲੋਕ ਹਰ ਈ ਕੋਈ ਵੀ ਸਿੱਖ ਧਰਮ ਵਿੱਚ ਸ ਹਰ ਇੱਕ ਦਾ ਸਤਿਕਾਰ ਉਸ ਨੂੰ ਉਸਨੂੰ ਉਸਦੇ ਗਲ ਵਿੱਚ ਸਰੋਪਾ ਪਾ ਕੇ ਕਰਦੇ ਹਨ ਅਤੇ ਲੋਕ ਉਸ ਦਾ ਬਹੁਤ ਹੀ ਪਿ ਅਤੇ ਉਸਨੂੰ ਬਹੁਤ ਹੀ ਪਿਆਰ ਅਤੇ ਉਸਨੂੰ ਬਹੁਤ ਹੀ ਸਤਿਕਾਰ ਦਿੰਦੇ ਹਨ ਸਾਨੂੰ ਕਿਸੇ ਲਈ ਵੀ ਸਿੱਖ ਧਰਮ ਵਿੱਚ ਕੋਈ ਕਿਸੇ ਲਈ ਵੀ ਮਾੜਾ ਬੋਲ ਨਹੀਂ ਬੋਲਦਾ ਹਰ ਇੱਕ ਉਸਦਾ ਸਤਿਕਾਰ ਕਰਦੇ ਹਨ ਸਾਨੂੰ ਕਿਸ ਸ ਸਾਨੂੰ ਹਰ ਇੱਕ ਦਾ ਭਲਾ ਸੋਚਣਾ ਚਾਹੀਦਾ ਹੈ ਸਿੱਖ ਧਰਮ ਵਿੱਚ ਲੋਕ ਧਾਰਮਿਕ ਯਾਤਰਾਵਾਂ ਜਿਵੇਂ ਕਿ ਅੰਮ੍ਰਿਤਸਰ ਆਨੰਦਪੁਰ ਸਾਹਿਬ ਵਿਖੇ ਤੀਰਥ ਯਾਤਰਾ ਲਈ ਜਾਂਦੇ ਹਨ ਅਤੇ ਲੋਕ ਸਭ ਲਈ ਅਰਦਾਸਾਂ ਦਾ ਅਰਦਾਸਾਂ ਦੀ ਪ੍ਰਾਰਥਨਾ ਕਰਦੇ ਹਨ